ਦੇਸ਼ ਵਿੱਚ ਉਪਲਬਧ ਹਸਪਤਾਲ ਅਤੇ ਡਾਕਟਰੀ ਸੇਵਾਵਾਂ ਬਾਰੇ ਸਾਡੀ ਰਾਏ ਹੈ ਕਿ ਜਿਹੜੇ ਸਾਡੇ ਸ਼ਹਿਰ ਦੇ ਵਿੱਚ ਹਸਪਤਾਲ ਨੇ ਉਹ ਬਹੁਤ ਹੀ ਮਤਲਬ ਕਿ ਇੱਕ ਵਧੀਆ ਕਿਸਮ ਮਤਲਬ ਕਿ ਨਹੀਂ ਆਉਂਦੀ ਹੈ ਜਿੱਦਾਂ ਕਿ ਬਹੁਤ ਕੋਈ ਵੱਡੀ ਬਿਮਾਰੀ ਵਾਲੇ ਮਰੀਜ਼ ਹੈ ਉਨ੍ਹਾਂ ਨੂੰ ਚੰਡੀਗੜ੍ਹ ਭੇਜਣਾ ਪੈ ਜਾਂਦਾ ਹੈ ਜਾਂ ਦਿੱਲੀ ਤੱਕ ਵੀ ਚਲੇ ਜਾਂਦੇ ਹੈ ਅਤੇ ਜਿਹੜੇ ਪ੍ਰਾਈਵੇਟ ਹਸਪਤਾਲ ਹੈ ਉਨ੍ਹਾਂ 'ਚ ਹੋ ਤਾਂ ਜਾਂਦਾ ਹੈ ਜੋ ਕਿ ਗਰੀਬ ਮਜੀ ਮਰੀਜ਼ ਹੈ ਉਹ ਅਫੋਰਡ ਨਹੀਂ ਕਰ ਸਕਦਾ ਉਹਦੇ ਬਾਹਰ ਤੋਂ ਉਹਦੇ ਮਤਲਬ ਕਿ ਜਿਹੜੀ ਆਰਥਿਕ ਸਥਿਤੀ ਹੈ ਉਹਦੀ ਇੰਨੀ ਨਹੀਂ ਹੁੰਦੀ ਜੋ ਕਿ ਉਹਨੂੰ ਸਖਸ਼ਮ ਹੋਵੇ ਅਤੇ ਇਸ ਕਰਕੇ ਗੌਰਮੈਂਟ ਨੂੰ ਚਾਹੀਦਾ ਹੈ ਕਿ ਕੁਛ ਐਹੇ ਜੇ ਡਾਕਟਰਾਂ ਦੀ ਭਰਤੀ ਕੀਤੀ ਜਾਵੇ ਹਸਪਤਾਲਾਂ ਦੇ ਵਿੱਚ ਐਹਜੀਆਂ ਨਵੀਆਂ ਸੁਵਿਧਾਵਾਂ ਦਿੱਤੀਆਂ ਜਾਣ ਤਾਂ ਜੋ ਮਰੀਜ਼ ਨੂੰ ਦੂਰ ਨਾ ਜਾਣਾ ਪਵੇ ਅਤੇ ਘੱਟੋ ਘੱਟ ਪੈਸੇ ਵਿੱਚ ਉਹਦਾ ਇਲਾਜ ਹੋ ਜਾਵੇ ਅਤੇ ਸਾਡੇ ਜਿਹੜੇ ਪਿੰਡ ਦੇ ਖੇਤਰ ਹੈ ਉਨ੍ਹਾਂ ਦੇ ਵਿੱਚ ਵੀ ਛੋਟੀਆਂ ਛੋਟੀਆਂ ਡਿਸਪੈਂਸਰੀਆਂ ਖੋਲ੍ਹ ਕੇ ਉੱਥੇ ਇਲਾਜ ਲੋਕਾਂ ਨੂੰ ਮਿਲ ਸਕੇ ਉਹਦੇ ਨਾਲ ਕੀ ਹੈ ਕਿ ਆਉਣ ਜਾਣ ਦਾ ਉਨ੍ਹਾਂ ਦੇ ਉੱਪਰ ਖਰਚਾ ਬਚ ਜਾਂਦਾ ਹੈ ਅਤੇ ਹਸਪਤਾਲ ਜਿਹੜੇ ਹੈ ਸ਼ਹਿਰ ਦੇ ਉੱਥੇ ਭੀੜ ਘੱਟ ਜਾਂਦੀ ਹੈ ਅਤੇ ਜਿੰਨੀ ਜਨਸੰਖਿਆ ਵੱਧ ਰਹੀ ਹੈ ਓਸ ਹਿਸਾਬ ਨਾਲ ਸਾਡੇ ਸ਼ਹਿਰ ਦੇ ਵਿੱਚ ਘੱਟੋ ਘੱਟ ਦੋ ਸਰਕਾਰੀ ਹਸਤਪਾਲ ਹੋਣੇ ਜ਼ਰੂਰੀ ਹੋ ਗਏ ਹੈ ਪ੍ਰਾਈਵੇਟ ਹੋਸਪਿਟਲ ਤਾਂ ਬਹੁਤ ਖੁੱਲ੍ਹ ਰਹੇ ਹੈ ਪਰ ਉਹ ਬਹੁਤ ਮਹਿੰਗੇ ਹੋ ਜਾਂਦੇ ਹੈ ਉਹ ਲੋਕ ਅਫੋਰਡ ਨਹੀਂ ਕਰ ਪਾ ਰਹੇ ਅਤੇ ਬਾਕੀ ਜਿਹੜੇ ਡਾਕਟਰਾਂ ਦੀ ਭਰਤੀ ਹੋਣੀ ਵੀ ਬਹੁਤ ਜ਼ਰੂਰੀ ਹੈ ਜਿੰਨੇ ਮਰੀਜ਼ ਵੱਧ ਰਹੇ ਹੈ ਡਾਕਟਰਾਂ ਦੀ ਸੰਖਿਆ ਉਹਦੇ ਨਾਲੋਂ ਕਿਤੇ ਘੱਟ ਹੁੰਦੀ ਹੈ ਅਤੇ ਇਸ ਕਰਕੇ ਲੋਕ ਥੋੜ੍ਹੇ ਜਿਹੇ ਵਾਂਝੇ ਰਹਿ ਜਾਂਦੇ ਹੈ ਇਲਾਜ ਤੋਂ ਇਸ ਲਈ ਅਸੀਂ ਤਾਂ ਇਹੀ ਕਹੂੰਗੇ ਵੀ ਡਾਕਟਰਾਂ ਦੀ ਭਰਤੀ ਬਹੁਤ ਜ਼ਰੂਰੀ ਹੈ ਅਤੇ ਹਸਪਤਾਲਾਂ ਦਾ ਥੋੜ੍ਹਾ ਜਿਹਾ ਨਵੀਨੀਕਰਨ ਕੀਤਾ ਜਾਵੇ ਤਾਂ ਜੋ ਲੋਕਾਂ ਦਾ ਇਲਾਜ ਹੋ ਸਕੇ